ਜਿਵੇਂ ਕਿ ਮੈਂ ਪ੍ਰਾਈਵੇਟ ਨੌਕਰੀ ਕਰਦਾ ਅਤੇ ਪ੍ਰਾਈਵੇਟ ਨੌਕਰੀਆਂ 'ਚ ਤਾਂ ਮੀਟਿੰਗਾਂ ਆਮ ਗੱਲ ਹੁੰਦੀਆਂ ਹਰ ਵੇਲੇ ਮੀਟਿੰਗ ਮਾੜੀ ਮਾੜੀ ਗੱਲ 'ਤੇ ਮੀਟਿੰਗ ਹੋ ਜਾਂਦੀਆਂ ਔਫਿਸ 'ਚ ਹੈਗਾ ਅਤੇ ਔਫਿਸ 'ਚ ਮੀਟਿੰਗ ਨਹੀਂ ਤਾਂ ਫਿਰ ਜੇ ਘਰ ਓਂ ਤਾਂ ਔਨਲਾਈਨ ਮੀਟਿੰਗ ਹੋ ਜਾਂਦੀ ਹੈ ਬੜਾ ਅੱਛਾ ਲੱਗਦਾ ਹੈਗਾ ਫਾਇਦਾ ਬੜਾ ਹੁੰਦਾ ਕਿਤੇ ਵੀ ਬੈਠੇ ਤੁਸੀਂ ਈਜ਼ੀਲੀ ਕਨੈਕਟ ਹੋ ਜਾਂਦੇ ਓਂ ਮੀਟਿੰਗ ਦੇ ਵਿੱਚ ਤੁਹਾਨੂੰ ਪਤਾ ਰਹਿੰਦਾ ਕੀ ਚੱਲ ਰਿਹਾ ਗੂਗਲ ਮੀਟ ਵਗੈਰਾ ਐਪਸ ਹੈਗੀਆਂ ਜਿਹੜੀਆਂ ਵਰਤਦੇ ਹਾਂ ਅਸੀਂ ਆਫਿਸ 'ਚ ਨੋਰਮਲੀ ਆਨਲਾਈਨ ਮੀਟਿੰਗ ਜੇ ਕਰਨੀ ਹੋਵੇ ਫਾਇਦੇ ਬਹੁਤ ਨੇ ਇਹਨਾਂ ਚੀਜ਼ਾਂ ਦੇ ਕਿ ਜਿੱਦਾਂ ਮੈਂ ਦੱਸਿਆ ਕਿ ਕਿਤੇ ਵੀ ਹੈਗਾ ਮੰਨ ਲਓ ਤੁਸੀਂ ਕਿਤੇ ਬਾਹਰ ਹੋ ਅਤੇ ਤੁਹਾਨੂੰ ਟੈਂਸ਼ਨ ਨਹੀਂ ਹੈ ਕਦੋਂ ਪਹੁੰਚਗੇ ਟਰੈਫਿਕ 'ਚ ਫਸੇ ਹੋ ਗੱਡੀ ਸਾਈਡ 'ਤੇ ਲਾਓ ਆਨਲਾਈਨ ਮੀਟਿੰਗ ਜੁਆਇਨ ਕਰ ਲਓ ਕਾਨਫਰੰਸ ਕਰਨੀ ਹੈ ਕਾਨਫਰੰਸ ਕਰ ਲਉ ਕਿਤੇ ਦੇਸ਼ ਤੋਂ ਬਾਹਰ ਹੋ ਸ਼ਹਿਰੋ ਬਾਹਰ ਹੋ ਅਤੇ ਆਪਣਾ ਆਰਾਮ ਨਾਲ ਤੁਸੀਂ ਮੀਟਿੰਗ ਕਰ ਸਕਦੇ ਹੋ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਕਦੋਂ ਬੰਦਾ ਆਏਗਾ ਕਦੋਂ ਨਹੀਂ ਆਏਗਾ ਵੇਟ ਕਰਨ ਦੀ ਲੋੜ ਨਹੀਂ ਆਪਣਾ ਨੈਟ ਓਨ ਕੀਤਾ ਐਪ 'ਚ ਕੀਤਾ ਅਤੇ ਮੀਟਿੰਗ ਸ਼ੁਰੂ ਆਪਣੀ ਗੱਲ ਕਰ ਲਈ ਹੁਣ ਮੀਟਿੰਗ ਜ਼ਰੂਰੀ ਡਿਸਕਸ਼ਨ ਹੁੰਦੀਆਂ ਜਿਹੜੀਆਂ ਹੋ ਜਾਂਦੀਆਂ ਫਾਇਦਾ ਵੀ ਹੈ ਅਤੇ ਕਹਿੰਦੇ ਨੇ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਨੁਕਸਾਨ ਵੀ ਹੈ ਜਿਵੇਂ ਕਿ ਦੱਸਿਆ ਕਿ ਕਿਸੇ ਵੀ ਟਾਈਮ 'ਚ ਕਨੈਕਟ ਕਰ ਸਕਦੇ ਹੁਣ ਮੰਨ ਲਉ ਮੈਂ ਛੁੱਟੀ 'ਤੇ ਹਾਂ ਕਈ ਵਾਰੀ ਹੁੰਦਾ ਫੋਨ ਆ ਜਾਂਦਾ ਮੀਟਿੰਗ ਹੈ ਅਟੈਂਡ ਕਰਨੀ ਹੈ ਕਨੈਕਟ ਕਰ ਲਿਉ ਆਨਲਾਈਨ ਅਤੇ ਛੁੱਟੀ ਦਾ ਕੋਈ ਫਾਇਦਾ ਹੀ ਨਹੀਂ ਰਹਿੰਦਾ ਇੱਕ ਵਾਰੀ ਮੀਟਿੰਗ ਸ਼ੁਰੂ ਹੋਈ ਘੰਟਾ ਘੰਟਾ ਦੋ ਦੋ ਘੰਟੇ ਨਿਕਲ ਜਾਂਦੇ ਅਤੇ ਨੁਕਸਾਨ ਰਹਿੰਦਾ ਫੈਮਿਲੀ ਵਾਲੇ ਕਹਿੰਦੇ ਛੁੱਟੀ ਲਈ ਤੁਸੀਂ ਸਾਡੇ ਲਈ ਅਤੇ ਲੱਗੇ ਆਪਣੀ ਮੀਟਿੰਗਾਂ ਕਰਨ ਅਤੇ ਮੀਟਿੰਗਾਂ ਚ ਟਾਈਮ ਨਿਕਲ ਜਾਂਦਾ ਘਰਦੇ ਕਹਿੰਦੇ ਇਹਦੇ ਨਾਲੋਂ ਤੂੰ ਦਫਤਰ ਚਲ ਜਾਂਦਾ ਇਹਦਾ ਨੁਕਸਾਨ ਹੈ ਤੁਹਾਡੀ ਫੈਮਲੀ ਲਾਈਫ ਖਤਮ ਹੋ ਜਾਂਦੀ ਹੈ ਹਰ ਵੇਲੇ ਆਫਿਸ ਤੋਂ ਫੋਨ ਮੀਟਿੰਗ ਹੈ ਜੀ ਗੱਲ ਕਰ ਲਓ ਕਦੀ ਕਲਾਈਂਟ ਨਾਲ ਕਰਨੀ ਕਦੀ ਕਿਸੇ ਨਾਲ ਕਰਨੀ ਹੈ ਅਤੇ ਦੂਜਾ ਨੁਕਸਾਨ ਜਿਹੜਾ ਮੈਨੂੰ ਲੱਗਦਾ ਇੱਕ ਅਲੱਗ ਹੀ ਪ੍ਰੈਸ਼ਰ ਬਣਿਆ ਰਹਿੰਦਾ ਹਰ ਵੇਲੇ ਦਿਮਾਗ 'ਤੇ ਕਿ ਕਾਲ ਨਾ ਆ ਜੇ ਮੀਟਿੰਗ ਵਾਸਤੇ ਕਾਲ ਨਾ ਆ ਜੇ ਮੀਟਿੰਗ ਵਾਸਤੇ ਮੰਨ ਲਓ ਮੈਂ ਬਹੁਤ ਰਿਲੈਕਸ ਮੂਡ 'ਚ ਬੈਠਾ ਹੈਗਾ ਘਰ ਨਾਰਮਲ ਖੁੱਲੇ ਕੱਪੜਿਆਂ ਚ ਫੋਨ ਆ ਗਿਆ ਇਕਦਮ ਕਿ ਮੀਟਿੰਗ ਦਸ ਮਿੰਟ 'ਚ ਜਾਂ ਪੰਜ ਮਿੰਟ 'ਚ ਜਾਂ ਹੁਣੇ ਜੁਆਇਨ ਕਰੋ ਟੈਂਸ਼ਨ ਭੱਜ ਨੱਠ ਪੈ ਜਾਂਦੀ ਹੈ ਚੱਜ ਦੇ ਕੱਪੜੇ ਪਾ ਲਈਏ ਦਿਮਾਗ 'ਤੇ ਪ੍ਰੈਸ਼ਰ ਹੀ ਹੈ ਅਨਨਿਸੈਸਰੀ ਪ੍ਰੈਸ਼ਰ ਪਈ ਜਾਂਦਾ ਮਾਈਡ 'ਤੇ